ਹੈਲੋ ਹੈਲੋ ਸਰ ਕੀ ਹਾਲ ਚਾਲ ਹੈ ਹਾਂਜੀ ਸਰ ਕੀ ਹਾਲ ਚਾਲ ਹੈ ਹਾਂਜੀ ਸਰ ਮੈਂ ਨਾ ਥੋੜ੍ਹੀ ਤੁਹਾਡੇ ਤੋਂ ਸਲਾਹ ਲੈਣੀ ਸੀ ਫਿਟਨੈੱਸ ਬਾਰੇ ਪੁੱਛਣਾ ਸੀ ਮੈਂ ਕਿ ਤੁਸੀਂ ਮੈਨੂੰ ਦੱਸੋ ਕਿ ਮੈਂ ਵੈਜ਼ੀਟੇਰੀਅਨ ਹਾਂ ਅਤੇ ਇਹਦੇ ਬਾਰੇ ਮੈਨੂੰ ਤੁਸੀਂ ਸੁਝਾਅ ਦਿਓ ਕਿ ਮੈਂ ਕਿਸ ਤਰ੍ਹਾਂ ਕਰ ਰੱਖ ਸਕਦੀ ਹਾਂ ਫਿੱਟ ਆਪਣੇ ਆਪ ਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਦੁੱਧ ਵਗੈਰਾ ਵੀ ਲੈ ਸਕਦੇ ਹਾਂ ਨਾ ਅਸੀਂ ਦੁੱਧ ਵਗੈਰਾ ਵੀ ਲੈ ਸਕਦੇ ਹਾਂ

ਠੀਕ ਹੈ ਸਰ ਠੀਕ ਹੈ ਥੈਂਕ ਯੂ ਥੈਂਕ ਯੂ ਸੋ ਮੱਚ ਸਰ